ਐਵੇਂ ਦੀ ਕੋਈ ਰਸਮ ਨਹੀਂ ਹੈ ਜਿਹੜੀ ਕਿ ਇੱਕ ਵਿਲੱਖਣ ਹੋਵੇ ਇੱਥੇ ਉਹੀ ਰਸਮਾਂ ਮਨਾਈਆਂ ਜਾਂਦੀਆਂ ਹਨ ਜਿਹੜੀਆਂ ਕਿ ਹੋਰ ਜਗ੍ਹਾ ਮਨਾਈਆਂ ਜਾਂਦੀਆਂ ਹਨ ਐਵੇਂ ਦੀ ਕੋਈ ਰਸਮ ਨਹੀਂ ਹੈ ਜਿਹੜੀ ਕਿ ਅਲੱਗ ਹੋਵੇ ਅਤੇ ਕੋਈ ਬਾਹਰ ਤੋਂ ਉਸਨੂੰ ਕੋਈ ਦੇਖਣ ਆਵੇ ਜੋ ਬਾਹਰ ਹੈ ਮਨਾਈ ਜਾਂਦੀ ਉਹ ਇੱਥੇ ਮਨਾਈ ਜਾਂਦੀ ਹੈ